ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਹੁਤ ਗੁਰਦੁਆਰੇ ਤਾਂ ਨਹੀਂ ਮੈਨੂੰ ਇੱਕ ਗੁਰਦੁਆਰੇ ਬਾਰੇ ਪਤਾ ਹੈਗਾ ਉਹ ਬਾਬਾ ਫਰੀਦ ਜੀ ਦਾ ਗੁਰਦੁਆਰਾ ਹੈਗਾ ਜਿਹੜਾ ਝ ਝੰਡੇ ਵਾਲਾ ਚੌਂਕ ਹੈਗਾ ਫਰੀਦਕੋਟ 'ਚ ਉਹਦੇ ਨੇੜੇ ਹੈਗਾ ਉਹ ਗੁਰ ਗੁਰਦੁਆਰਾ ਉੱਥੇ ਹਰ ਵੀਰਵਾਰ ਦੇ ਵੀਰਵਾਰ ਉੱਥੇ ਮੇਲਾ ਲੱਗਦਾ ਹੈਗਾ ਅੱਛਾ ਹਾਂ ਮੈਂ ਤੁਹਾਨੂੰ ਟੂਰਿਸਟ ਗਾਰਡ ਦਾ ਨੰਬਰ ਦੇ ਦਿੰਦਾ ਉਹ ਤੁਸੀਂ ਲਿਖ ਲਓ ਲਿਖੋ ਨਾਇਨ ਏਟ ਸੇਵੇਨ ਏਟ ਸਿਕਸ ਵਨ ਟੂ ਟੂ ਥ੍ਰੀ ਏਟ ਇਹਨਾਂ ਦਾ ਨੇਮ ਜੀ ਮਨਜੀਤ ਸਿੰਘ ਹੈਗਾ ਹਾਂਜੀ ਤੁਹਾਨੂੰ ਪੂਰਾ ਦੱਸ ਦੇਣਗੇ ਪੂਰਾ ਤੁਹਾਨੂੰ ਗਾਈਡ ਕਰ ਦੇਣਗੇ ਹਾਂਜੀ ਤੁਹਾਨੂੰ ਸਾਰਾ ਦੱਸ ਦੇਣਗੇ ਤੁਹਾਨੂੰ ਪ੍ਰੋਪਰ ਗਾਈਡ ਕਰਨਗੇ ਤੁਹਾਨੂੰ ਪੂਰਾ ਫਰੀਦਕੋਟ ਦੇ ਗੁਰਦੁਆਰੇ ਸਾਰੇ ਦਿਖਾਉਣਗੇ ਉਹਨਾਂ ਬਾਰੇ ਹਰ ਇੱਕ ਚੀਜ਼ ਦੱਸਣਗੇ ਹਾਂਜੀ ਉਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਤੁਸੀਂ ਇਹਨਾਂ ਨਾਲ ਹੀ ਗੱਲ ਕਰ ਲੈਣਾ ਹਾਂਜੀ ਅੱਛਾ ਵੈਸੇ ਜਿਹੜਾ ਬਾਬਾ ਫਰੀਦ ਗੁਰਦੁਆਰੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਉਹ ਜਿਹੜਾ ਗੁਰਦੁਆਰਾ ਹੈਗਾ ਉੱਥੇ ਹਰ ਵੀਰਵਾਰ ਦੇ ਵੀਰਵਾਰ ਉੱਥੇ ਮੇਲਾ ਲੱਗਦਾ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਹੈਗਾ ਉਵੇਂ ਦੀ ਉੱਥੇ ਅੱਗੇ ਪਿੱਛੇ ਬਜ਼ਾਰ ਤਾਂ ਲੱਗਦੇ ਹੈਗਾ ਸਮਾਨ ਵਾਧੂ ਵੇਖਿਆ ਹੈਗਾ ਲੇਕਿਨ ਵੀਰਵਾਰ ਨੂੰ ਖਾਸ ਉੱਥੇ ਬਹੁਤ ਜ਼ਿਆਦਾ ਪੀੜ ਹੁੰਦੀ ਆ ਉਦੋਂ ਵੀਰਵਾਰ ਤੋਂ ਪਹਿਲਾਂ ਆਪਾਂ ਜਦੋ ਵੀਰਵਾਰ ਨਹੀਂ ਹੁੰਦਾ ਉਦੋਂ ਆਪਾਂ ਵਿਹਕਲ ਅੰਦਰ ਲੈ ਕੇ ਜਾ ਸਕਦੇ ਆਪਾਂ ਸਾਹਮਣੇ ਵੀ ਪਾਰਕ ਕਰ ਸਕਦੇ ਹਾਂ ਅਤੇ ਜਦੋਂ ਉੱਥੇ ਮੇਲਾ ਲੱਗਿਆ ਹੁੰਦਾ ਵੀਰਵਾਰ ਨੂੰ ਉਦੋਂ ਮੋਟਰਸਾਈਕਲ ਉਹ ਬਾਹਰ ਖੜ੍ਹਾ ਦਿੰਦੇ ਆ ਆਪਾਂ ਉਹਨਾਂ ਨੂੰ ਅੰਦਰ ਨਹੀਂ ਲੈ ਕੇ ਜਾ ਸਕਦੇ ਆਪਾਂ ਨੂੰ ਪਰਮਿਸ਼ਨ ਨਹੀਂ ਹੈਗੀ ਠੀਕ ਹੈ ਉੱਥੇ ਬਾਜ਼ਾਰ ਨਾਲੇ ਹਰ ਤਰ੍ਹਾਂ ਦਾ ਲੱਗਦਾ ਹਰ ਤਰ੍ਹਾਂ ਦਾ ਸਮਾਨ ਉੱਥੇ ਮਿਲ ਜਾਂਦਾ ਹੈਗਾ ਠੀਕ ਆ ਠੀਕ ਆ ਓਕੇ ਬਾਏ